ਹੈਲੋ ਹਾਂਜੀ ਫੋਟੋ ਸਟੇਟਮੈਂਟ ਵਾਲੀ ਦੁਕਾਨ ਤੋਂ ਬੋਲ ਰਹੇ ਹੋ ਜੀ ਮੈਂ ਜੀ ਕੁਛ ਨਾ ਪੇਜ ਕਰਵਾਉਣੇ ਸੀ ਫੋਟੋਸਟੇਟ ਜਿਵੇਂ ਕਹਿ ਲਓ ਵੀ ਇੱਕ ਦੋ ਕਿਤਾਬਾਂ ਹੀ ਹੈਗੀਆਂ ਵੀ ਮੈਂ ਉਹਨਾਂ ਨੂੰ ਪੂਰਾ ਪੂਰਾ ਫੋਟੋਸਟੇਟ ਕਰਵਾਉਣਾ ਤੇ ਉਸ ਤੋਂ ਬਾਅਦ ਵੀ ਉਹਨਾਂ ਦੀ ਮੈਂ ਬਾਇੰਡਿੰਗ ਵੀ ਕਰਵਾਉਣੀ ਹ ਤੇ ਵੀ ਕੀ ਤੁਹਾਡਾ ਹੈ ਵੀ ਪ੍ਰਾਈਜ ਵਗੈਰਾ ਮੰਨ ਲਓ ਪੇਜ ਨੂੰ ਦੋਨਾਂ ਪਾਸਿਆਂ ਤੋਂ ਫੋਟੋਸਟੇਟ ਕਰਵਾਈਏ ਤਾਂ ਪਰ ਪੇਜ ਅੱਛਾ ਜੀ ਦੋਨਾਂ ਸਾਈਡਾਂ ਤੋਂ ਵੀ ਪੇਜ ਫੋਟੋਸਟੇਟ ਕਰੋਗੇ ਅੱਛਾ ਅੱਛਾ ਇਕ ਰੁਪਿਆ ਤੇ ਜੇ ਮੰਨ ਲਓ ਅਸੀਂ ਦੇਖੋ ਹੁਣ ਤੁਹਾਡੇ ਕੋਲ ਕਾਫੀ ਜਿਆਦਾ ਪੇਜ ਕਰਵਾਉਣੇ ਆ ਤਾਂ ਕੋਈ ਰਿਆਇਤ ਕਰੋਗੇ ਲੈਸ ਵਗੈਰਾ ਕੁਛ ਅੱਛਾ ਅੱਛਾ ਹਾਂ ਚਲੋ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਇਹ ਮੇਰੇ ਕੋਲ ਜੀ ਦੋ ਕਿਤਾਬਾਂ ਹੈਗੀਆਂ ਤੇ ਫਿਰ ਉਸ ਤੋਂ ਬਾਅਦ ਬਾਇੰਡਿੰਗ ਵੀ ਕਰਦਿਓਗੇ ਕਿਤਾਬ ਮਤਲਬ ਪੇਜਾਂ ਨੂੰ ਤੇ ਬਾਈਡਿੰਗ ਬਾਈਡਿੰਗ ਹੋਈ ਤੁਸੀਂ ਕਰੋਗੇ ਜਿਹੜੀ ਅੱਜ ਕੱਲ ਚੱਲਦੀ ਹੈ ਲੈਮੀਨੇਸ਼ਨ ਵਾਲੀ ਅੱਛਾ ਮਤਲਬ ਇੱਕ ਸੈੱਟ ਦਾ ਤੁਸੀਂ ਪੰਜਾਹ ਰੁਪਇਆ ਲਓਗੇ ਤੇ ਬਵੀ ਬਾਈਡਿੰਗ ਵਧੀਆ ਹੋਊਗੀ ਨਾ ਵੀ ਉਹ ਵਿੱਚੋਂ ਫਿਰ ਪੇਜ ਨਿਕਲਦੇ ਨਾ ਫਿਰਨ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂ ਹਾਂ ਚਲੋ ਚਲੋ ਠੀਕ ਹੈ ਜੀ ਵੀ ਇਹ ਮੈਂ ਦੋ ਜਾਂ ਤਿੰਨ ਕਿਤਾਬਾਂ ਹੈਗੀਆਂ ਮੇਰੇ ਕੋਲ ਤੇ ਇੱਕ ਦੋ ਦਿਨਾਂ ਤੱਕ ਮੈਂ ਆਉਂਗੀ ਤੁਹਾਡੀ ਸ਼ੋਪ ਤੇ ਫਿਰ ਮੈਂ ਆਪ ਕੋਲ ਖੜ ਕੇ ਤੁਹਾਡੇ ਕੋਲ ਵੀ ਸਾਰੇ ਕਰਵਾ ਲਾਂਗੇ ਫੋਟੋਸਟੇਟ ਪੇਜ ਤੇ ਉਸ ਤੋਂ ਬਾਦ ਤੁਸੀਂ ਇਹਨਾਂ ਨੂੰ ਬਾਇਡ ਵੀ ਕਰਦੇ ਆ ਜੇ ਸੈਟਸ ਨੂੰ ਹਾਂ ਹਾਂ ਚਲੋ ਠੀਕ ਹ ਜੀ ਮੈਂ ਮੋਰਨਿੰਗ ਆ ਕੇ ਨਾ ਸਾਰਾ ਤੁਹਾਨੂੰ ਵੀ ਦੱਸ ਦੂਗੀ ਵੀ ਕਿਵੇਂ ਕਿਵੇਂ ਕਰਨੇ ਹੈਗੇ ਆ ਕਿੰਨੇ ਸੈਟ ਬਣਾਉਣੇ ਆ ਤੇ ਕਿੰਨਿਆਂ ਦੀ ਬਾਇਡਿੰਗ ਕਰਨੀ ਐ ਹਾ ਹਾਂਜੀ ਹਾਂਜੀ ਹਾਂਜੀ ਉਹ ਪੇਜ ਮਤਲਬ ਹਾਂ ਬੁੱਕ ਹੀ ਆ ਜੀ ਉਹ ਸੀਰੀਅਲ ਵਾਈਜ਼ ਹੀ ਆ ਪੇਜ ਉਹਦੇ ਚ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਵੀ ਤੁਹਾਨੂੰ ਬਾਰ ਬਾਰ ਚੈੱਕ ਕਰਨਾ ਪਏਗਾ ਪੇਜਜ ਨੂੰ ਹਾਂਜੀ ਉਹ ਹਾਂ ਹਾਂ ਚਲੋ ਕੋਈ ਨੀ ਮੈਂ ਆ ਕੇ ਨਾ ਇੱਕ ਦੋ ਪੇਜ ਤੁਸੀਂ ਫੋਟੋਸੈਟ ਕਰਕੇ ਦਿਖਾਓ ਮੈਂ ਥੋੜਾ ਕੁਆਲਿਟੀ ਦੇਖ ਲਾਂਗੀ ਵੀ ਕਈ ਵਾਰ ਉਹ ਮਧਮ ਹਾਂ ਵੀ ਪੇਜ ਵਗੈਰਾ ਤੋਂ ਜੋ ਵੀ ਲਿਖਿਆ ਹੈਗਾ ਉਹ ਵਧੀਆ ਵਿਜੀਬਲ ਹੋਏ ਹਾਂਜੀ ਹਾ ਠੀਕ ਹੈ ਜੀ ਹਾਂ ਕੋਈ ਗੱਲ ਨਹੀਂ ਜੀ ਮੈਂ ਦੇਖ ਲਾਂਗੀ ਹਾਂ ਚਲੋ ਠੀਕ ਹੈ ਜੀ ਥੈਂਕਯੂ ਤੁਹਾਡਾ ਓ ਹਾਂ ਜਰੂਰ ਜੀ ਜਰੂਰ ਮੈਂ ਇੱਕ ਦੋ ਦਿਨਾਂ ਤੱਕ ਆਉਂਗੀ ਠੀਕ ਹੈ ਜੀ